ਹੈਲੋ ਹਾਂਜੀ ਭਾਅ ਜੀ ਨਮਸਤੇ ਜੀ ਹਾਂਜੀ ਤੁਸੀਂ ਗ੍ਰੀਨ ਹੋਟਲ ਤੋਂ ਗੱਲ ਕਰ ਰਹੇ ਹੋ ਹਾਂਜੀ ਅਸੀਂ ਇੱਥੋਂ ਖਾਣ ਪੀਣ ਵਾਲੀਆਂ ਚੀਜ਼ਾਂ ਮੰਗਵਾਈਆਂ ਸੀ ਜੋ ਕਿ ਸਾਨੂੰ ਬਹੁਤ ਪਸੰਦ ਆਈਆਂ ਅਸੀਂ ਦੋ ਤਿੰਨ ਆਈਟਮਾਂ ਮੰਗਵਾਈਆਂ ਸੀ ਪੀਜ਼ਾ ਪਾਸਤਾ ਵਗੈਰਾ ਹੁਣ ਸਾਨੂੰ ਉਹਨਾਂ ਦੀ ਕੁਆਂਟਿਟੀ ਜ਼ਿਆਦਾ ਚਾਹੀਦੀ ਹੈ ਅਸੀਂ ਸਾਨੂੰ ਤੁਹਾਡੀ ਸਰਵਿਸ ਬਹੁਤ ਚੰਗੀ ਲੱਗੀ ਅਸੀਂ ਇੱਥੋਂ ਹੀ ਸਮਾਨ ਮੰਗਵਾਉਂਦੇ ਹਾਂ ਸਾਡੀ ਫੈਮਿਲੀ ਡੇਅ ਨਾਈਟ ਡਿਨਰ 'ਤੇ ਤੁਹਾਡੇ ਵੱਲ ਹੀ ਆਉਂਦੀ ਹੈ ਇਸ ਕਰਕੇ ਸਾਨੂੰ ਵਧੀਆ ਟ੍ਰੀਟਮੈਂਟ ਤੁਹਾਡੀ ਟ੍ਰੀਟਮੈਂਟ ਬੜੀ ਚੰਗੀ ਲੱਗੀ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜਾ ਵੀ ਸਮਾਨ ਅਸੀਂ ਮੰਗਵਾਇਆ ਸਾਨੂੰ ਉਹਦੇ ਨਾਲ ਖੁਸ਼ੀ ਮਿਲੀ ਇਸ ਕਰਕੇ ਦੋ ਤਿੰਨ ਆਈਟਮਾਂ ਸਾਡੀਆਂ ਵੱਧ ਜੋੜੀਆਂ ਜਾਣ ਅਤੇ ਸਾਨੂੰ ਉਹਦੇ ਨਾਲ ਬਿੱਲ ਵੀ ਸਾਡਾ ਸ਼ਾਮ ਨੂੰ ਪਾਸ ਕੀਤਾ ਜਾਵੇ ਸਾਡੇ ਘਰ ਗੈਸਟ ਆਏ ਹਨ ਜਿਸ ਕਰਕੇ ਸਾਨੂੰ ਅੋਰਡਰ ਵੱਧ ਤੁਹਾਨੂੰ ਕਰਨਾ ਪੈ ਰਿਹਾ ਇਸ ਕਰਕੇ ਸਾਡਾ ਅੋਰਡਰ ਟਾਈਮ ਨਾਲ ਭੇਜਿਆ ਜਾਵੇ ਅਤੇ ਸਾਡਾ ਬਿੱਲ ਵੀ ਨਾਲ ਹੀ ਪਾਸ ਕੀਤਾ ਜਾਵੇ ਅਤੇ ਸਾਨੂੰ ਤੁਹਾਡੇ ਹੋਟਲ ਦੇ ਸਾਨੂੰ ਤੁਹਾਡੇ ਹੋਟਲ ਦੀ ਡੈਕੋਰੇਸ਼ਨ ਵੀ ਬਹੁਤ ਪਸੰਦ ਆਉਂਦੀ ਹੈ ਸਾਨੂੰ ਉੱਥੇ ਦੇ ਤੁਹਾਡੇ ਦੇ ਵੇਟਰਸ ਜਿਹੜੇ ਹੈ ਉਹਨਾਂ ਦੀ ਟ੍ਰੀਟਮੈਂਟ ਬਹੁਤ ਚੰਗੀ ਲੱਗਦੀ ਹੈ ਇਸ ਕਰਕੇ ਅਸੀਂ ਹਮੇਸ਼ਾ ਤੁਹਾਡੇ ਉ ਉੱਥੋਂ ਹੋਟਲ ਤੋਂ ਹੀ ਅੋਰਡਰ ਕਰਨਾ ਪਸੰਦ ਕਰਦੇ ਹਾਂ ਹਰ ਚੀਜ਼ ਵਿੱਚ ਤੁਹਾਡੇ ਇੱਕ ਅਲੱਗ ਹੀ ਸਵਾਦ ਹੁੰਦਾ ਹੈ ਇਸ ਕਰਕੇ ਜੋ ਵੀ ਤੁਸੀਂ ਭੇਜਦੇ ਹੋ ਸਾਡੀ ਫੈਮਲੀ ਮੈਂਬਰ ਸਾਡੇ ਰਿਲੇਟਿਵ ਸਾਰਿਆਂ ਨੂੰ ਬਹੁਤ ਚੰਗੀ ਲੱਗਦੀ ਹੈ ਇਸ ਕਰਕੇ ਅਸੀਂ ਹੁਣ ਜਿਹੜੀ ਵੀ ਅੋਰਡਰ ਤੁਹਾਨੂੰ ਕੀਤਾ ਹੈ ਉਸਨੂੰ ਵਧਾ ਕੇ ਦੋ ਤਿੰਨ ਆਇਟਮਾਂ ਵੱਧ ਕਰਕੇ ਸਾਨੂੰ ਭੇਜਿਆ ਜਾਵੇ ਅਤੇ ਉਹਨਾਂ ਦਾ ਬਿੱਲ ਸਮੇਤ ਸਾਨੂੰ ਅੋਰਡਰ ਵਿੱਚ ਭੇਜਿਆ ਜਾਵੇ ਅਸੀਂ ਬੁਹਤ ਬਹੁਤ ਧੰਨਵਾਦ ਕਰਦੇ